ਹੈਲੋ ਹਾਂ ਮਿੱਤਰ ਕੀ ਹਾਲ ਨੇ ਥੋੜ੍ਹਾ ਸਮੇਂ ਦੀ ਲੋੜ ਸੀ ਮੈਂ ਕੱਲ੍ਹ ਸੁਬਾਹ ਚੰਡੀਗੜ੍ਹ ਜਾਣਾ ਅਤੇ ਮੈਨੂੰ ਜਾਣ ਲਈ ਕਿਸੇ ਕੈਬ ਦੀ ਜ਼ਰੂਰਤ ਹੈ ਤੂੰ ਅਕਸਰ ਕੈਬ 'ਤੇ ਜਾਂਦਾ ਰਹਿੰਦਾ ਆਂ ਅਤੇ ਮੈਂ ਇਸ ਕਰਕੇ ਤੈਨੂੰ ਫੋਨ ਕੀਤਾ ਕਿ ਤੂੰ ਮੇਰੀ ਥੋੜ੍ਹੀ ਮਦਦ ਕਰੇਗਾ ਮੈਂ ਤੇਰੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਔਲਾ ਕੈਬਸ ਦੀ ਜੋ ਸਰਵਿਸ ਹੈ ਉਹ ਕਿਸ ਤਰ੍ਹਾਂ ਦੀ ਹੈ ਕਿ ਉਹ ਡਰਾਈਵਿੰਗ ਸਹੀ ਤਰ੍ਹਾਂ ਕਰਦੇ ਨੇ ਜਾਂ ਕੋਈ ਨਸ਼ਾ ਪੱਤਾ ਤਾਂ ਨਹੀਂ ਖਾਂਦੇ ਔਰ ਉਹ ਰਸਤੇ ਵਿੱਚ ਕਿੱਥੇ ਕਿੱਥੇ ਰੁਕਦੇ ਨੇ ਅਤੇ ਕੀ ਖਰਚਾ ਲੈਂਦੇ ਹਾਂ ਮੈਨੂੰ ਇਹ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸ ਦੇਵੇ ਤਾਂ ਕਿ ਮੈਨੂੰ ਸਫ਼ਰ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਹਾਂ ਹਾਂ ਕੀ ਚਾਰਜ ਲੈਂਦੇ ਨੇ ਇਹ ਦਸ ਰੁਪਏ ਪ੍ਰਤੀ ਕਿਲੋਮੀਟਰ ਠੀਕ ਹੈ ਓਕੇ ਮਿੱਤਰ ਸ਼ੁਕਰੀਆ